ਪਿਛਲੇ ਕੁਝ ਸਾਲਾਂ ਵਿੱਚ ਮੋਬਾਇਲ ਗੇਮਿੰਗ ਦੀ ਦੁਨੀਆ ਵਿੱਚ ਬਹੁਤ ਵੱਡਾ ਉਭਾਰ ਆਇਆ ਹੈ ਜਿਸ ਕਰਕੇ ਸਾਰੀਆਂ ਵੀ ਜਿੰਨੀਆਂ ਵੀ ਗੇਮਾਂ ਜਾਂ ਉਹ ਘਰ ਵਿੱਚ ਖੇਡਣ ਵਾਲੀਆਂ ਹੋਣ ਚਾਹੇ ਉਹ ਬਾਹਰ ਜਾ ਕੇ ਖੇਡਣ ਵਾਲੀਆਂ ਹੋਣ ਉਹ ਸਾਰੀਆਂ ਹੀ ਇੱਕ ਹੀ ਇੱਕ ਮੋਬਾਈਲ ਵਿੱਚ ਸਮਾ ਗਈਆਂ ਹਨ ਚਾਹੇ ਉਹਦੇ ਵਿੱਚ ਤੁਸੀਂ ਜਿੰਨੀਆਂ ਮਰਜ਼ੀ ਗੇਮਾਂ ਖੇਡੀ ਜਾਓ ਉਹ ਸਭ ਤੇ ਸਭ ਇੱਕ ਮੋਬਾਈਲ ਵਿੱਚ ਹੀ ਤੁਹਾਨੂੰ ਉਪਲਬਧ ਹੁੰਦੀਆਂ ਹਨ ਜਿੱਥੇ ਕਿ ਪਹਿਲਾਂ ਸਸ ਬੱਚੇ ਆਪਣੇ ਘਰ ਤੋਂ ਬਾਹਰ ਦੁਕਾਨਾਂ 'ਤੇ ਜਾ ਕੇ ਟੀਵੀਜ ਵੱਡੇ ਵੱਡੇ ਟੀ ਵੀ ਸਲ ਗੇਮਾਂ ਜਿਹੜੀਆਂ ਹੁੰਦੀਆਂ ਸੀਗੀਆਂ ਵੀ ਸੀ ਟੀ ਵਗੈਰਾ ਉਹਨਾਂ 'ਤੇ ਗੇਮਾਂ ਖੇਡਦੇ ਹੁੰਦੇ ਸੀਗੇ ਕੋਂਇਨਸ ਵਗੈਰਾ ਲਗਾ ਕੇ ਇਹ ਕੋਂਇਨ ਦੇ ਇੱਕ ਘੰਟੇ ਲਈ ਤੁਹਾਨੂੰ ਗੇਮ ਖੇਡਣ ਨੂੰ ਮਿਲੂਗੀ ਇੱਦਾਂ ਕਰਕੇ ਗੇਮਾਂ ਖੇਡਦੇ ਹੁੰਦੇ ਸੀ ਅਤੇ ਉਹਦਾ ਉਤਸ਼ਾਹ ਵੀ ਬਥੇਰਾ ਹੁੰਦਾ ਸੀ ਅੱਜ ਕੱਲ੍ਹ ਉਹਦਾ ਉਤਸ਼ਾਹ ਵੀ ਇੰਨਾ ਨਹੀਂ ਹੈਗਾ ਅਤੇ ਜੇ ਅਸੀਂ ਇਸ ਦੀ ਗੱਲ ਕਰੀਏ ਤਾਂ ਉਦਯੋਗ ਵਿੱਚ ਅੱਗੇ ਵੱਡੀ ਮਾਤਰਾ ਦੇ ਵਿੱਚ ਗੇਮਿੰਗਸ ਜਿਹੜੇ ਹੁੰਦੇ ਸੀਗੇ ਸੋਫਟਵੇਅਰ ਵਗੈਰਾ ਜਿਹੜੇ ਟੂਲਸ ਹੁੰਦੇ ਸੀਗੇ ਹਾਰਡਵੇਅਰ ਹੁੰਦੇ ਸੀ ਉਹ ਕਾਫੀ ਵੱਡੀ ਮਾਤਰਾ ਪ੍ਰੋਡਕਸ਼ਨ ਵਿੱਚ ਹੁੰਦੇ ਸੀਗੇ ਜਦੋਂ ਦਾ ਮੋਬਾਈਲ ਫੋਨ ਆਇਆ ਹੈ ਸਾਰੇ ਤਰ੍ਹਾਂ ਦੇ ਜਿਹੜੀਆਂ ਪ੍ਰੋਡਕਸ਼ਨ ਫੈਕਟਰੀਆਂ ਸੀਗੀਆਂ ਉਹਨਾਂ 'ਤੇ ਤਕਰੀਬਨ ਤਾਲਾ ਲੱਗਣ ਵਾਲਾ ਹੀ ਹਿਸਾਬ ਹੈ